ਮੈਨੂੰ ਨਵੀਆਂ ਨਵੀਆਂ ਪਕਵਾਨਾਂ ਬਾਰੇ ਜਾਨਣਾ ਬਹੁਤ ਵਧੀਆ ਲਗਦਾ ਹੈ ਅਤੇ ਉਹ ਰੈਸੀਪੀਆਂ ਬਣਾ ਬਣਾ ਕੇ ਖਾਣਾ ਅਤੇ ਦੂਜਿਆ ਨੂੰ ਖਲਾਣਾ ਵੀ ਮੈਂ ਯੂਟਿਊਬ 'ਤੇ ਨਵੀਂ ਨਵੀਂ ਵਿਡਿਓਸ ਦੇਖਦੀ ਹਾਂ ਤਾਂ ਫਿਰ ਉਮੇਂ ਹੀ ਮੈਂ ਓਹ ਰੈਸਿਪੀ ਬਣਾਨੀ ਹਾਂ ਫਿਰ ਜਦੋਂ ਉਹ ਮੈਂ ਰੈਸਿਪੀ ਬਣਾਨੀ ਹਾਂ ਅਤੇ ਮੈਂ ਸਭ ਨੂੰ ਖਵਾਨੀ ਹਾਂ ਅਤੇ ਮਤਲਬ ਖੁਦ ਵੀ ਖਾਂਦੀ ਹਾਂ ਕਿਉਂਕਿ ਇਹ ਮੇਰਾ ਸ਼ੌਂਕ ਹੈ ਕਿ ਮੈਂ ਵਧੀਆ ਚੀਜ਼ਾਂ ਬਣਾਵਾਂ ਅਤੇ ਨਵੀਂ ਨਵੀਂ ਚੀਜ਼ਾਂ ਸਿੱਖਾਂ ਅਤੇ ਮਤਲਬ ਜਿਵੇਂ ਕਿ ਕੁਛ ਵੀ ਹੈ ਜੋ ਕੁਛ ਵੀ ਮੈਂ ਬਣਾਨੀ ਹਾਂ ਮੈਂ ਇਹ ਸੋਚਦੀ ਹਾਂ ਕਿ ਵੱਧ ਤੋਂ ਵੱਧ ਲੋਕਾਂ ਨਾਲ ਉਹਨੂੰ ਵੰਡ ਕੇ ਖਾ ਸਕਾਂ ਕਿ ਇਕੱਲੇ ਕਦੇ ਵੀ ਕੋਈ ਚੀਜ਼ ਖਾਈ ਦਾ ਸਵਾਦ ਨਹੀਂ ਹੁੰਦਾ ਜੇ ਆਪਾਂ ਲੋਕਾਂ ਨਾਲ ਵੰਡ ਕੇ ਚੀਜ਼ ਖਾਈਏ ਤਾਂ ਓਹਦਾ ਸਵਾਦ ਡਬਲ ਹੋ ਜਾਂਦਾ ਹੈ ਅਤੇ ਮੈਂ ਹਮੇਸ਼ਾਂ ਮਤਲਬ ਯੂਟਿਊਬ ਤੋਂ ਵੀਡੀਓਸ ਦੇਖਦੀ ਰਹਿੰਦੀ ਹਾਂ ਜਦੋਂ ਵੀ ਮੈਂ ਵਿਹਲੀ ਹੁੰਦੀ ਹਾਂ ਤਾਂ ਮੈਂ ਵੀਡੀਓਜ਼ ਦੇਖ ਕੇ ਰਸੋਈ 'ਚ ਜਾ ਕੇ ਕੁਛ ਨਾ ਕੁਛ ਬਣਾਨੀ ਹਾਂ ਜਿਵੇਂ ਮੈਂ ਹੁਣ ਪਿੱਛੇ ਡੋਸਾ ਬਣਾਇਆ ਸੀ ਬਰਗਰ ਬਣਾਇਆ ਸੀ ਮੈਂ ਇਹ ਸਭ ਕੁਛ ਦੇਖ ਕੇ ਬਣਾਨੀ ਹਾਂ ਕਿਉਂਕਿ ਬਾਹਰ ਦਾ ਖਾਣ ਤੋਂ ਚੰਗਾ ਜੇ ਆਪਾ ਓਹ ਚੀਜ਼ ਘਰੇ ਬਣਾਈਏ ਅਨਹੈਲਦੀ ਤਾਂ ਹੁੰਦੀ ਹੈ ਚਲੋ ਬਟ ਇੰਨੀ ਵੀ ਨਹੀਂ ਹੁੰਦੀ ਕਿ ਜਿਹੜੀ ਬਾਹਰਲੇ ਪਰੋਡਕਟ ਹੁੰਦੇ ਹੈ ਓਹ ਆਪਣੇ ਘਰ ਬਣਾਏ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਓਹ 'ਚ ਕਿ ਪਾਇਐ ਅਤੇ ਕੀ ਨਹੀਂ ਤਾਂ ਇਸ ਕਰਕੇ ਮੈਨੂੰ ਇਹ ਚੀਜ਼ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਯੂਟਿਊਬ ਰਾਹੀਂ ਆਪਣਾ ਸ਼ੌਂਕ ਪੂਰਾ ਕਰਦੀ ਹਾਂ